ਅੱਜ ਕੱਲ ਦੇ ਲੋਕ ਬਹੁਤ ਹੀ ਅੰਧਵਿਸ਼ਵਾਸਾਂ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਥਾਂ ਥਾਂ 'ਤੇ ਜਾ ਕੇ ਮੱਥੇ ਟੇਕਦੇ ਹਨ ਉਹ ਜਾ ਕੇ ਪੰਡਤਾਂ ਉਹ ਪੰਡਤਾਂ ਕੋਲ ਜਾਂਦੇ ਹਨ ਜੋ ਕਿ ਉਹਨਾਂ ਨੂੰ ਗਲਤ ਰਾਹ 'ਤੇ ਪਾ ਦਿੰਦੇ ਹਨ ਉਹ ਚੋਰਾਹੇ 'ਤੇ ਟੂਣਾ ਕਰਦੇ ਹਨ ਅਤੇ ਭੂਤ ਪ੍ਰੇਤਾਂ ਬਾਰੇ ਵੀ ਵਿਸ਼ਵਾਸ ਰੱਖਦੇ ਹੈਂ ਜੋ ਕਿ ਬਹੁਤ ਗਲਤ ਹੈ